ਪੰਜਾਬ ਦੇ ਲੋਕ ਬਹੁਤ ਹੀ ਮਿੱਠੇ ਅਤੇ ਇਹਨਾਂ ਦੀ ਬੋਲੀ ਵੀ ਬੜੀ ਮਿੱਠੀ ਅਤੇ ਪਿਆਰੀ ਹੈ ਇਸ ਕਰਕੇ ਹੀ ਇਹ ਧਾਰਮਿਕ ਪ੍ਰੰਪਰਾਵਾਂ ਵਿੱਚ ਵੀ ਬਹੁਤ ਯੋਗਦਾਨ ਦਿੰਦੇ ਹਨ ਅਤੇ ਰਸਮਾਂ ਦਾ ਪਾਲਣ ਕਰਦੇ ਹਨ ਇਹ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਮਾਨਿਅਤਾ ਦੇ ਅਨੁਸਾਰ ਇੱਕ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ ਇਸ ਲਈ ਉਹ ਇਸ ਲਈ ਉਹ ਪ੍ਰਾਰਥਨਾਵਾਂ ਕਰਦੇ ਹਨ ਗ੍ਰੰਥ ਪੜ੍ਹਦੇ ਹਨ ਭੇਟਾ ਗਾਉਂਦੇ ਹਨ ਅਤੇ ਕਈ ਤੀਰਥ ਸਥਾਨਾਂ 'ਤੇ ਜਾਂਦੇ ਹਨ ਜਿੱਥੇ ਜਾ ਕੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਉਹਨਾਂ ਦੀ ਇੱਕ ਮਾਨਤਾ ਹੁੰਦੀ ਹੈ ਕਿ ਅਸੀਂ ਕੋਈ ਧਰਮ ਦਾ ਕੰਮ ਕਰ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੂੰ ਆਪਣੇ ਕਰਮ ਸੁਧਾਰਨ ਦਾ ਵੀ ਮੌਕਾ ਮਿਲਦਾ ਹੈ ਅਤੇ ਇਹ ਰਸਮਾ ਯਾਤਰਾਵਾਂ ਕਰਕੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਉਹਨਾਂ ਨੂੰ ਇਹ ਕਾਰਜ ਰੱਬ ਅੱਗੇ ਕੀਤੀ ਹੋਈ ਅਰਦਾਸ ਦੇ ਬਰਾਬਰ ਹੈ ਇਸ ਕਰਕੇ ਪੰਜਾਬ ਦੇ ਲੋਕ ਇਹ ਸਭ 'ਚ ਬਹੁਤ ਵਿਸ਼ਵਾਸ ਕਰਦੇ ਹਨ ਇਸ ਦੇ ਨਾਲ ਨਾਲ ਹੀ ਉਹ ਇਸ ਦੇ ਨਾਲ ਨਾਲ ਹੀ ਉਹ ਲੰਗਰ ਆਦਿ ਲਗਾ ਕੇ ਵੀ ਲੋਕਾਂ ਨੂੰ ਗਰੀਬ ਲੋਕਾਂ ਨੂੰ ਬਹੁਤ ਕੁਛ ਵੰਡਦੇ ਹਨ ਰੋਟੀ ਦੀ ਸੇਵਾ ਕਰਦੇ ਹਨ ਪਾਣੀ ਦੀ ਸੇਵਾ ਕਰਦੇ ਹਨ ਜਿਸ ਨਾਲ ਉਹ ਕੁਝ ਚੰਗੇ ਕਰਮ ਕਰਕੇ ਆਪਣੇ ਆਪ ਨੂੰ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ